ਹੈਲੋ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਦੇਖੋ ਬੇਟਾ ਪੰਜਾਬੀ ਯੂਨੀਵਰਸਿਟੀ 'ਚ ਇਸ ਟਾਈਮ ਜੋ ਪਲੱਸ ਟੂ ਤੋਂ ਬਾਅਦ ਬੱਚਿਆਂ ਲਈ ਕੋਰਸ ਅਵੇਲੇਬਲ ਉਹ ਫਾਈਵ ਯੀਅਰ ਇੰਟਰਗ੍ਰੇਟਰ ਕੋਰਸਿਸ ਹੈ ਜਿਸ 'ਚ ਐੱਮ ਏ ਸ਼ੋਸ਼ਲ ਸਾਇੰਸ ਆ ਜਾਂਦੀ ਹੈ ਔਰ ਬੀ ਏ ਐੱਲ ਐੱਲ ਬੀ ਹੈ ਨਹੀਂ ਤਾਂ ਤੁਸੀਂ ਦੋਨੋਂ ਕੋਰਸਿਸ ਲਈ ਅਲੀਜੀਬਲ ਹੋ ਸੋ ਸ਼ੋਸ਼ਲ ਸਾਇੰਸ ਦੇ ਵਿੱਚ ਐਵੇਂ ਆ ਕਿ ਤੁਸੀਂ ਬੀ ਏ ਦੇ ਨਾਲ ਐੱਮ ਏ ਤੁਹਾਡੀ ਇਕੱਠੀ ਹੋ ਜਾਏਗੀ ਠੀਕ ਹੈ ਨਾ ਜਿਸ 'ਚ ਤੁਸੀਂ ਇਕਨੋਮਿਕਸ ਪੋਲੀਟੀਕਲ ਸਾਇੰਸ ਸਾਈਕੋਲੋਜੀ ਪਬਲਿਕ ਐਡ ਇਹ ਸਾਰੇ ਕੋਰਸਿਸ ਨਾਲ ਦੀ ਨਾਲ ਪੜੋਂਗੇ ਅਤੇ ਬੀ ਏ ਐੱਲ ਐੱਲ ਬੀ ਹੈ ਕਿ ਤੁਸੀਂ ਬੀ ਏ ਦੇ ਨਾਲ ਐੱਲ ਐੱਲ ਬੀ ਦੀ ਡਿਗਰੀ ਲੈ ਕੇ ਤੁਸੀਂ ਅੱਗੇ ਫਿਰ ਆਪਣੀ ਫਰਦਰ ਐੱਲ ਐੱਲ ਐੱਮ ਲਈ ਜਾ ਸਕਦੇ ਹੋ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਤੁਹਾਡਾ ਇੰਟਰਸਟ ਕਿਸ ਸਾਈਡ ਹੈ ਤੁਸੀਂ ਸੋਸ਼ਲ ਸਾਇੰਸ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਲੋਇਅਰ ਬਣਨਾ ਚਾਹੁੰਦੇ ਹੋ ਠੀਕ ਹੈ ਫਿਰ ਠੀਕ ਹੈ ਬੇਟਾ ਫਿਰ ਤੁਹਾਡੇ ਲਈ ਬੈਸਟ ਸੂਟੇਬਲ ਹੈ ਸੋਸ਼ਲ ਸਾਇੰਸਿਸ ਉਸ 'ਚ ਤੁਹਾਡੇ ਨਾਲ ਦੀ ਨਾਲ ਜਿਵੇਂ ਕੰਪੀਟੀਟਿਵ ਇੰਗਜ਼ਾਮ ਦੇ ਇੱਥੇ ਸਾਡੇ ਕੋਚਿੰਗ ਸੈਂਟਰ ਵੀ ਆਈ ਐੱਸ ਕੋਚਿੰਗ ਸੈਂਟਰ ਤੁਸੀਂ ਉੱਥੇ ਨਾਲ ਦੀ ਨਾਲ ਆਪਣੇ ਕੋਚਿੰਗ ਕਲਾਸਿਸ ਈਵਨਿੰਗ ਦੇ ਵਿੱਚ ਹੁੰਦੇ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ ਜਿਹੜਾ ਤੁਹਾਡੇ ਲਈ ਹੈਲਪਫੁੱਲ ਰਹੇਗਾ ਕਿ ਤੁਸੀਂ ਆਪਣੇ ਫਰਦਰ ਜੋ ਗਰਮੈਂਟ ਜੋਬ ਦੇ ਇੰਗਜ਼ਾਮ ਜਾਂ ਕੰਪੀਟੀਟਿਵ ਇੰਗਜ਼ਾਮਜ਼ ਹੈ ਉਹਨਾਂ ਦੀ ਤਿਆਰੀ ਕਰ ਸਕਦੇ ਹੋ ਤੋ ਮੇਰੇ ਅਕੋਡਿੰਗ ਤੁਹਾਡੇ ਲਈ ਸੋਸ਼ਲ ਸਾਇੰਸ ਵਾਲਾ ਕੋਰਸ ਸੂਟੇਬਲ ਰਹੇਗਾ ਤੋ ਇਹਦੇ ਨਾਲ ਰਿਲੇਟਡ ਤੋ ਫਰਦਰ ਅੱਗੇ ਐਡਮਿਸ਼ਨ ਦੀਆਂ ਡੇਟਸ ਹੈ ਔਰ ਜਿਹੜਾ ਫੀ ਸਟਕਚਰ ਹੈ ਉਹ ਮੈਂ ਤੁਹਾਨੂੰ ਤੁਹਾਡੇ ਨੰਬਰ 'ਤੇ ਵਟਸਐਪ ਕਰ ਦਿੰਦੀ ਹਾਂ ਤੁਸੀਂ ਉਸ ਅਕੋਡਿੰਗ ਪਲੈਨ ਕਰਕੇ ਫਿਰ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਦਿਓ ਅਤੇ ਔਨਲਾਈਨ ਪੋਰਟਲ ਦੇ ਥਰੂ ਹੀ ਅਪਲਾਈ ਹੋਏਗਾ ਠੀਕ ਹੈ ਜੀ ਓਕੇ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਕੈਂਪਸ ਦੇ ਅੰਦਰ ਹੀ ਕੋਚਿੰਗ ਇੰਸਟੀਟਿਊਟ ਹੈ ਜੀ ਓਕੇ ਜੀ ਓਕੇ ਜੀ